ਹੈਲੋ ਹਾਂਜੀ ਹਾਂਜੀ ਦੱਸੋ ਜੀ ਹਾਂਜੀ ਜ਼ਰੂਰ ਜੀ ਆਓ ਜੀ ਹਾਂਜੀ ਜੀ ਜੀ ਉਹ ਵਾਹਿਗੁਰੂ ਜੀ ਤੁਹਾਡੀ ਇੱਛਾ ਹੁੰਦੀ ਹੈ ਕਿ ਤੁਸੀਂ ਕੋਈ ਰਸਤ ਲੈ ਕੇ ਆਉਣੀ ਆ ਰਸਤ ਵੀ ਲੈ ਸਕਦੇ ਜੇ ਜੇਕਰ ਤੁਸੀਂ ਮਾਇਆ ਭੇਟ ਕਰਨਾ ਚਾਹੁੰਦੇ ਤਾਂ ਤੁਹਾਨੂੰ ਮਾਇਆ ਦੀ ਰਸਾ ਰਸੀਦ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਵੱਲੋਂ ਦੇ ਦਿੱਤੀ ਜਾਵੇਗੀ ਉਹ ਤੁਹਾਡੀ ਇੱਛਾ ਜੀ ਹਾਂਜੀ ਜ਼ਰੂਰ ਜੀ ਹਾਂਜੀ ਗੁਰਦੁਆਰਾ ਸਾਹਿਬ ਦੀਆਂ ਸਰਾਂਵਾਂ ਬਣੀਆਂ ਹੋਈਆਂ ਨੇ ਚੌਵੀ ਘੰਟੇ ਲੰਗਰ ਚੱਲਦਾ ਹੈ ਤੁਸੀਂ ਬਰਤਨ ਧੌਣ ਦੀ ਜਾਂ ਲੰਗਰ ਵਰਤਾਉਣ ਦੀ ਜਿਵੇਂ ਵੀ ਤੁਹਾਡੀ ਕੋਈ ਵੀ ਇੱਛਾ ਹੱਥੀਂ ਸੇਵਾ ਕਰਨ ਦੀ ਤੁਸੀਂ ਕਰ ਸਕਦੇ ਹੋ ਹਾਂਜੀ ਗੁਰਦੁਆਰਾ ਸਾਹਿਬ ਦੀਆਂ ਵਹੀਕਲ ਬੱਸਾਂ ਮੌਜੂਦ ਨੇ ਜੋ ਰੋਜ਼ਾਨਾ ਹੀ ਆਸ ਪਾਸ ਦੇ ਗੁਰਦੁਆਰਿਆਂ ਵਿੱਚ ਦਰਸ਼ਨ ਕਰਵਾਉਣ ਵਾਸਤੇ ਸੰਗਤ ਨੂੰ ਜਾਂਦੀਆਂ ਨੇ ਤੁਸੀਂ ਜਾ ਸਕਦੇ ਹੋ ਹਾਂਜੀ ਚੌਵੀ ਘੰਟੇ ਲੰਗਰ ਦਾ ਪ੍ਰਬੰਧ ਹੈ ਜੀ ਧੰਨਵਾਦ ਜੀ